ਡੁੰਘਾਈ ਅਤੇ ਮਾਪ ਬਨਾਉਣ ਲਈ ਡਰਾਇੰਗ ਵਿੱਚ ਰੋਸ਼ਨੀ ਅਤੇ ਪਰਛਾਵੇ ਦੀ ਵਰਤੋਂ ਕੁਝ ਇਸ ਪ੍ਰਕਾਰ ਕੀਤੀ ਜਾ ਸਕਦੀ ਹੈ ਵੈਸੇ ਤਾਂ ਕੁਝ ਲੋਕ ਤੇਲ ਦਾ ਉਪਯੋਗ ਕਰਨਾ ਪਸੰਦ ਕਰਦੇ ਹਨ ਲੇਕਿਨ ਮੈਂ ਸ਼ੌਂਕ ਬਨਾਨਾ ਪਸੰਦ ਕਰਦੀ ਹਾਂ ਕਿਉਂਕਿ ਇਸ ਤਰਹਾਂ ਪ੍ਰਕਾਸ਼ ਦੁਆਰਾ ਪਹੁੰਚਿਆ ਗਿਆ ਅਧਿਕ ਸਪਸ਼ਟ ਹੁੰਦਾ ਹੈ ਪਹਿਲਾਂ ਕਦਮ ਤਾਂ ਕੋਰ ਸੈਡੋ ਅਤੇ ਹਾਈਲਾਈਟ ਨੂੰ ਪੇਂਟ ਕਰਨਾ ਹੈ ਤਾਂ ਕਿ ਪਤਾ ਚਲ ਸਕੇ ਕਿ ਰੋਸ਼ਨੀ ਕਿੱਥੋਂ ਆ ਰਹੀ ਹੈ ਫਿਰ ਮੈਂ ਸੰਦਰਭ ਦੇ ਰੂਪ ਵਿੱਚ ਪਹਿਲੇ ਬਣਾਏ ਗਏ ਗ੍ਰਹਿ ਸਕੇਲ ਦਾ ਉਪਯੋਗ ਕਰਕੇ ਇੱਕ ਇੱਕ ਕਰਕੇ ਸ਼ੇਡਸ ਨੂੰ ਉੱਤੇ ਜਾਂ ਥੱਲੇ ਕਰਦੀ ਆਂ